ਹੈਲੋ ਹਾਂਜੀ

ਹਾਂਜੀ ਹਾਂਜੀ ਹਾਂਜੀ ਭਾਅ ਜੀ ਸਵੇਰੇ ਨੌਂ ਕੁ ਵਜੇ ਨਾਲ ਚੱਲੀ ਦਾ ਜੀ ਅਤੇ ਉੱਥੇ ਪਹੁੰਚ ਜਾਈ ਦਾ ਵਾ ਦੋ ਕੁ ਵਜੇ ਤੱਕ ਹਾਂਜੀ ਦੋ ਕੁ ਵਜੇ ਤੱਕ ਜੇ ਟਰੈਫਿਕ ਜ਼ਿਆਦਾ ਨਾ ਹੋਏ ਤਾਂ ਦੋ ਵਜੇ ਤੱਕ ਅਤੇ ਅਤੇ ਇੱਕ ਡੇਢ ਵਜੇ ਤੱਕ ਵੀ ਪਹੁੰਚ ਜਾਈ ਦਾ ਜੇ ਜ਼ਿਆਦਾ ਜਲਦੀ ਹੋਏ ਕਿਸੇ ਨੂੰ ਤੇਜ਼ ਵੀ ਥੋੜ੍ਹੀ ਜਿਹੀ ਚਲਾ ਲਈ ਦੀ ਹੈ ਹਾਂਜੀ ਏ ਸੀ ਵਗੈਰਾ ਤਾਂ ਹੈਗਾ ਵਾ ਜੀ ਹੈ ਸਹੀ ਹੈ ਬਸ ਠੀਕ ਠੀਕ ਹੀ ਹੈ ਮਤਲਬ ਚਲਦਾ ਹਾਂ ਜੇ ਮਤਲਬ ਕਿ ਜ਼ਿਆਦਾ ਅਸੀਂ ਤੇਜ਼ ਚਲਾਈ ਦਾ ਨਹੀਂ ਮਤਲਬ ਨੋਰਮਲ ਚਲਦਾ ਰਹਿੰਦਾ ਉਹ ਤਾਂ ਹਾਂਜੀ ਚਲਦਾ ਹੀ ਆ ਓਕੇ ਹੈ ਰਿਪੋਟ ਕੋਈ ਚੱਕਰ ਨਹੀਂ ਹੈ ਹਾਂਜੀ ਹਾਂਜੀ ਏ ਸੀ ਦੀ ਫੈਸਿਲਿਟੀ ਤਾਂ ਹੈਗੀ ਆ ਉੱਦਾਂ ਤਾਂ ਕੋਈ ਚੱਕਰ ਨਹੀਂ ਹੈ ਬਸ ਥੋੜ੍ਹਾ ਜਿਹਾ ਫਿਰ ਪੈਟਰੋਲ ਵਗੈਰਾ ਜ਼ਿਆਦਾ ਲੱਗਦਾ ਥੋੜ੍ਹਾ ਜਿਹਾ ਫਿਰ ਉਹਦੇ ਚਾਰਜਿਸ ਵਗੈਰਾ ਥੋੜ੍ਹਾ ਜਿਹਾ ਐਕਸਟਰਾ ਥੋੜ੍ਹੇ ਜਿਹੇ ਲੈ ਲਈ ਦੇ ਆ ਹਾਂਜੀ ਨੋਰਮਲ ਚਾਰਜਿਸ ਉੱਦਾਂ ਉੱਦਾਂ ਅਸੀਂ ਤਿੰਨ ਹਜ਼ਾਰ ਰੁਪਇਆ ਲਈ ਦਾ ਵਾ ਇੱਥੋਂ ਚੰਡੀਗੜ੍ਹ ਜਾਣ ਦਾ ਅਤੇ ਜੇ ਏ ਸੀ ਲਾ ਕੇ ਜਾਣਾ ਫਿਰ ਪੈਂਤੀ ਸੌ ਰੁਪਇਆ ਲੈ ਲਈ ਦਾ ਵਾ ਹਾਂਜੀ ਪ੍ਰਬੰਧ ਤਾਂ ਕਰ ਦਾਂਗੇ ਬਸ ਤੁਸੀਂ ਜਾਣਾ ਤਾਂ ਨਹੀਂ ਉੱਦਾਂ ਕਿੰਨੇ ਕਿਨ ਹਾਂਜੀ ਹਾਂਜੀ ਅਤੇ ਕਿੰਨੇ ਕੁ ਵਜੇ ਨਾਲ ਜਾਣਾ ਤੁਸੀਂ ਉੱਦਾਂ ਉਹ ਤੋਂ ਬਾਅਦ ਵੀ ਹਾਂਜੀ ਹਾਂਜੀ ਦਸ ਸਾਢੇ ਦਸ ਵਜੇ ਵੀ ਚੱਲਦੀ ਇਕ ਠੀਕ ਹੈ ਜੀ ਠੀਕ ਠੀਕ ਹਾਂਜੀ ਹਾਂਜੀ ਏ ਸੀ ਤਾਂ ਹੈਗਾ ਵਾ ਜੀ ਉੱਦਾਂ ਦਾ ਕੋਈ ਇਸ਼ੂ ਨਹੀਂ ਬਸ ਥੋੜ੍ਹਾ ਜਿਹਾ ਚਾਰਜਿਸ ਉਹਦੇ ਐਕਸਟਰਾ ਫਾਈਵ ਹੰਡਰਡ ਜੇ ਇੱਥੋਂ ਜਾਣਾ ਤੁਸੀਂ ਇੰਨਾ ਕੁ ਰੂਲ ਦੇ ਹਿਸਾਬ ਨਾਲ ਓਕੇ ਜੀ ਓਕੇ ਠੀਕ ਥੈਂਕ